ਬੋਲੀਵੁੱਡ ਟੋਲੀਵੁੱਡ ਨੇ ਭਾਰਤ ਵਿੱਚ ਹਰ ਥਾਂ ਫੈਸ਼ਨ ਰੁਝਾਨਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤੇ ਜਾਂਦਾ ਹੈ ਬੋਲੀਵੁੱਡ ਵਿੱਚ ਜਿਹੜੇ ਮੋਡਲਸ ਕੱਪੜੇ ਪਹਿਨਦੀਆਂ ਏ ਉਹਨਾਂ ਨੂੰ ਜਿਹੜੇ ਬੱਚੇ ਆ ਅੱਜ ਕੱਲ੍ਹ ਦੇ ਉਹ ਆਪਣਾ ਰੋਲ ਮੋਡਲ ਮੰਨ ਰਹੇ ਹਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਈ ਤਾਂ ਬਹੁਤ ਕਈ ਬੋਲੀਵੁੱਡ ਦੇ ਪਿੱਚਰ ਦੇ ਵਿੱਚ ਬਹੁਤ ਘਟੀਆ ਪਹਿਰਾਵਾ ਪਹਿਨਿਆ ਜਾਂਦਾ ਹੈ ਕਈਆਂ ਦੇ ਵਿੱਚ ਬਹੁਤ ਵਧੀਆ ਵੀ ਪਹਿਨਿਆ ਜਾਂਦਾ ਹੈ ਠੀਕ ਹੈ ਤਾਂ ਜਿਹੜੇ ਬੱਚੇ ਆ ਉਹ ਉਹਨਾਂ ਨੂੰ ਹੀ ਫੋਲੋ ਕਰ ਰਹੇ ਆ ਮਤਲਬ ਕਿ ਜਿਹੜਾ ਉਹ ਉਹਨਾਂ ਦਾ ਆਪਣਾ ਵਿਰਸਾ ਏ ਆਪਣੇ ਪਹਿਰਾਵਾ ਏ ਉਹ ਭੁੱਲਦੇ ਜਾ ਰਹੇ ਹਨ ਉਹ ਛੱਡਦੇ ਜਾ ਰਹੇ ਹਨ ਅਤੇ ਉਹ ਜਿਹੜੇ ਜਿਹੜਾ ਬੋਲੀਵੁੱਡ ਫਿਲਮਾਂ ਦੇ ਵਿੱਚ ਫੈ ਕੱਪੜੇ ਜਿਹੜੇ ਰੋਲ ਮੋਡਲਸ ਹੈ ਜਿਹੜੇ ਪਹਿਨਦੇ ਹੈ ਉਹ ਉਹਨਾਂ ਨੂੰ ਅਪਣਾਉਂਦੇ ਹਨ ਉਹਨਾਂ ਨੂੰ ਹੀ ਜਿਹੜਾ ਫੋਲੋ ਕਰਦੇ ਹਨ ਠੀਕ ਹੈ ਤਾਂ ਜਿਹੜਾ ਇਹ ਸਾਡੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਖ਼ਤਰਨਾਕ ਸਾਬਿਤ ਹੋ ਸਕਦਾ ਏ ਜਿ ਬਟ ਮੈਨੂੰ ਤਾਂ ਜਿਹੜਾ ਬੋਲੀਵੁੱਡ ਕੱਪੜਿਆਂ ਦੀ ਸ਼ੈਲੀ ਹੈ ਉਹ ਪਸੰਦ ਨਹੀਂ ਹੈਗੀ ਅਤੇ ਨਾ ਹੀ ਮੈਂ ਕਦੇ ਇਹੋ ਜਿਹਾ ਪਹਿਰਾਵਾ ਜਿਹੜਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਮੈਂ ਜਿਹੜੇ ਗਿੱਧਾ ਏ ਗਿੱਧੇ ਮਤਲਬ ਜਿਸ ਤਰ੍ਹਾਂ ਪੰਜਾਬੀ ਫ਼ਿਲਮਾਂ ਦੇਖਦੇ ਉਹਦੇ ਵਿੱਚ ਗਿੱਧਾ ਹੁੰਦਾ ਉਹਦੇ ਵਿੱਚ ਆਪਾਂ ਉਹਨਾਂ ਨੇ ਘੱਗਰੇ ਪਾਏ ਹੁੰਦੇ ਮੈਂ ਉਹ ਜ਼ਰੂਰ ਬਣਾਇਆ ਏ ਉਹ ਮੈਂ ਆਪਣੀ ਸਿਸਟਰ ਦੀ ਮੈਰਿਜ 'ਤੇ ਪਾਇਆ ਵਾ ਸੀਗਾ ਅਤੇ ਮੈਂ ਮੈਨੂੰ ਬਹੁਤ ਪਸੰਦ ਵੀ ਹੈ ਉਹ